ਨਮਸਕਾਰ ਜੀ ਮੇਰਾ ਨਾਮ ਸ਼ਸ਼ੀ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਅੱਜ ਕੱਲ੍ਹ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਪਸ਼ੂ ਰੱਖੇ ਹੁੰਦੇ ਹਨ ਜਿਵੇਂ ਆਪਣੇ ਘਰਾਂ ਦੇ ਵਿੱਚ ਅਸੀਂ ਜਿਵੇਂ ਕੁੱਤੇ ਰੱਖੇ ਦੇ ਨੇ ਅਤੇ ਉਹਦੇ ਨਾਲ ਇਹ ਵੈ ਵੀ ਸਾਨੂੰ ਆਪਣੇ ਕੁੱਤਿਆਂ ਦੇ ਨਾਲ ਉਹਨਾਂ ਦਾ ਵੀ ਪੂਰਾ ਧਿਆਨ ਰੱਖਣਾ ਪੈਂਦਾ ਉਹਨਾਂ ਦੇ ਸਿਹਤ ਬਾਰੇ ਉਹਨਾਂ ਨੂੰ ਟਾਈਮ ਟਾਈਮ 'ਤੇ ਟੀਕਾਕਰਨ ਕਰਾਉਣਾ ਜ਼ਰੂਰੀ ਹੈ ਅਤੇ ਉਹਨਾਂ ਦਾ ਚੈੱਕਅਪ ਕਰਾਉਣਾ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਉਹਨਾਂ ਨੂੰ ਟਾਈਮ ਨਾਲ ਟੀਕਾਕਰਨ ਨਹੀਂ ਕਰਾਵਾਂਗੇ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਨੇ ਅਤੇ ਜਿੱਦਾਂ ਵੀ ਉਹਨਾਂ ਨੂੰ ਕੀੜੇ ਹੋਣਾ ਜਿਵੇਂ ਜਿਹਨਾਂ ਨੂੰ ਕੀੜੇ ਪੈ ਜਾਂਦੇ ਆ ਅਤੇ ਉਹਨਾਂ ਨੂੰ ਜੇ ਅਸੀਂ ਟਾਈਮ ਨਾਲ ਉਹਨਾਂ ਨੂੰ ਟੀਕਾਕਰਨ ਕਰਾਇਆ ਹੋਇਆ ਹੈਗਾ ਅਤੇ ਸਾਡੇ ਕੁੱਤਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗ ਸਕਦੀ ਅਤੇ ਉਹਨਾਂ ਦੇ ਪ੍ਰੋਪਰ ਜਿਵੇਂ ਅਸੀਂ ਟੀਕਾਕਰਨ ਤੋਂ ਬਾਅਦ ਉਹਨਾਂ ਨੂੰ ਕਈ ਵਾਰੀ ਗਰਮੀ ਦਾ ਕਸੂਰ ਹੋ ਜਾਂਦਾ ਉਹਨਾਂ ਨੂੰ ਗਰਮੀ ਲੱਗ ਜਾਂਦੀ ਹੈ ਅਤੇ ਉਹਨੂੰ ਅਸੀਂ ਹਸਪਤਾਲ 'ਚ ਲਿਜਾ ਕੇ ਉਹਨਾਂ ਦਾ ਕੋਈ ਕੁਛ ਵਗੈਰਾ ਲਗਵਾਉਂਦੇ ਆ ਅਤੇ ਜਦੋਂ ਜਦੋਂ ਅਸੀਂ ਕੁੱਤਿਆਂ ਨੂੰ ਕੁੱਤਿਆਂ ਨੇ ਮਤ ਕਿ ਉਹਨਾਂ ਨੂੰ ਮਿਲਣਾ ਨਾ ਕਰਾਣਾ ਹੋਵੇ ਤਾਂ ਅਸੀਂ ਉਹਨਾਂ ਨੂੰ ਹਸਪਤਾਲ 'ਚ ਲੈ ਕੇ ਜਾਣਾ ਤਾਂ ਉਹਨਾਂ ਦਾ ਇੱਕ ਟੀਕਾ ਲਗਵਾ ਕੇ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਉਹਨਾਂ ਤੋਂ ਕੁੱਤਿਆਂ ਤੋਂ ਕੁੱਤਿਆਂ ਤੋਂ ਬੱਚੇ ਅਸੀਂ ਲੈ ਸਕਦੇ ਹਾਂ ਅਤੇ ਅਤੇ ਅਸੀਂ ਉਹਨਾਂ ਦੇ ਬੱਚਿਆਂ ਉਹਨਾਂ ਨੂੰ ਉਸ ਟਾਈਮ 'ਤੇ ਵੀ ਅਸੀਂ ਉਹਨਾਂ ਨੂੰ ਪੂਰੇ ਪ੍ਰੋਪਰ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਵੀ ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਬੱਚੇ ਦੇਣੇ ਆ ਉਹ ਵੀ ਤੰਦਰੁਸਤ ਰਹਿੰਦੇ ਉਹਨਾਂ ਦਾ ਟਾਈਮ ਦੇ ਨਾਲ ਹੀ ਉਹਨਾਂ ਦਾ ਅਸੀਂ ਉਹਨਾਂ ਨੂੰ ਚੈਕਅਪ ਕਰਵਾਉਂਦੇ ਰਹਿੰਦੇ ਹਾਂ ਕਿਉਂਕਿ ਜਦੋਂ ਉਹਨੂੰ ਬੱਚੇ ਦੇਣ ਦਾ ਟਾਇਮ ਆਉਂਦਾ ਹੈ ਤਾਂ ਉਹ ਸਮੇਂ ਨਾਲ ਆਪਣੇ ਜੇ ਖੁਰਾਕ ਦੇ ਨਾਲ ਨਾਲ ਉਹਨਾਂ ਨੂੰ ਤੰਦਰੁਸਤ ਬੱਚੇ ਵੀ ਪੈਦਾ ਕਰ ਸਕਣ ਅਤੇ ਕਈ ਵਾਰੀ ਹੁੰਦਾ ਵੀ ਜਦੋਂ ਅਸੀਂ ਉਹਨਾਂ ਵੱਲ ਨਹੀਂ ਧਿਆਨ ਦਿੰਦੇ ਤੇ ਉਹਨਾਂ ਦੇ ਬੱਚੇ ਅੰਦਰ ਹੀ ਮਰ ਜਾਂਦੇ ਹਨ ਜਾਂ ਤਾਂ ਫਿਰ ਉਹਨਾਂ ਨੂੰ ਕਈ ਬੱਚੇ ਬਚਦੇ ਹੀ ਨਹੀਂ ਹੈ ਇਸ ਕਰਕੇ ਸਾਨੂੰ ਉਹਨਾਂ ਦੇ ਬੱਚਿਆਂ ਨੂੰ ਨਾਲ ਨਾਲ ਹੀ ਕੁੱਤਿਆਂ ਦੇ ਕੁੱਤੀ ਦੇ ਨਾਲ ਨਾਲ ਹੀ ਉਹਨਾਂ ਦਾ ਬੱਚਿਆਂ ਦਾ ਵੀ ਧਿਆਨ ਰੱਖਦੇ ਹੋਏ ਆ ਉਹਨਾਂ ਨੂੰ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਅਤੇ ਇਹ ਜਦਾਂ ਜਦੋਂ ਅਸੀਂ ਆਪਣਾ ਇਹਨੂੰ ਬਿਜ਼ਨਸ ਹੀ ਬਣਾ ਲੈਂਦੇ ਹਾਂ ਤਾਂ ਸਾਨੂੰ ਉਹਨਾਂ ਨੂੰ ਵੀ ਆਪਣੇ ਕੁੱਤਿਆਂ ਨੂੰ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਹੀ ਰੱਖਣਾ ਪੈਂਦਾ ਹੈ ਅਤੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਅਸੀਂ ਉਹਨੂੰ ਦੇਖਭਾਲ ਕਰਦੇ ਹਾਂ ਅਤੇ ਅਤੇ ਉਹਨਾਂ ਦਾ ਰੁਟੀਨ ਨਾਲ ਚੈੱਕਅਪ ਕਰਦੇ ਹਾਂ ਜੇ ਅਸੀਂ ਉਹਨਾਂ ਦਾ ਧਿਆਨ ਨਹੀਂ ਰੱਖਾਂਗੇ ਅਤੇ ਉਹਨਾਂ ਨੂੰ ਆਪਣੇ ਪਤੀ ਦੇ ਬੱਚਿਆਂ ਨੂੰ ਵੀ ਨੁਕਸਾਨ ਹੋ ਸਕਦਾ ਅਤੇ ਸਾਡੀ ਕੀਤੀ ਹੋਈ ਮਿਹਨਤ ਵੀ ਬੇਕਾਰ ਹੋ ਜਾਂਦੀ ਜਿਹਦੇ ਨਾਲ ਸਾਡੇ ਬਿਜਨਸ ਨੂੰ ਬਹੁਤ ਫਰਕ ਪੈਂਦਾ ਹੈ ਜੇ ਅਸੀਂ ਪ੍ਰੋਪਰ ਟਾਈਮ ਨਾਲ ਉਹਨਾਂ ਨੂੰ ਟੀਕਾਕਰਨ ਵਗੈਰਾ ਜੋ ਵੀ ਹੁੰਦਾ ਅਸੀਂ ਉਹਨਾਂ ਨਾਲ ਹਸਪਤਾਲ ਦਾ ਕਾਰਡ ਬਣਵਾਇਆ ਹੁੰਦਾ ਅਤੇ ਉਹਨਾਂ ਨੂੰ ਇਹ ਟਾਈਮ ਦੇ ਨਾਲ ਹੀ ਉਹਨਾਂ ਨੂੰ ਚੈੱਕਅਪ ਕਰਵਾ ਕੇ ਅਸੀਂ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਵੇਚ ਕੇ ਅਸੀਂ ਆਪਣਾ ਕਮਾਈ ਦਾ ਸਰੋਤ ਵੀ ਬਣਾ ਸਕਦੇ ਹਾਂ ਅਤੇ ਉਹਨਾਂ ਦੀ ਦੇਖਭਾਲ ਵੀ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਧੰਨਵਾਦ